ਹੈਲੋ ਸਤਿ ਸ਼੍ਰੀ ਅਕਾਲ ਦੀਪ ਕਿਵੇਂ ਹੋ ਹੋਰ ਠੀਕ ਹੋ ਬਸ ਵਧੀਆ ਮੈਨੂੰ ਇਦਾਂ ਦੱਸੋ ਸਰਟੀਫਿਕੇਟ 'ਤੇ ਨਾ ਨਾਮ ਵਿਚ ਕੁਰੈਕਸ਼ਨ ਕਰਵਾਉਣੀ ਹੈ ਅਤੇ ਉਹ ਕੁਰੈਕਸ਼ਨ ਕਿਥੋਂ ਹੋਊਗੀ ਕਿਵੇਂ ਹੋਊਗੀ ਹਾਂਜੀ ਹਾਂਜੀ

ਓਕੇ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਕਿਹੜੇ ਫਲੋਰ 'ਤੇ ਜਾਣਾ ਆਪਾਂ ਉਸ ਤੋਂ ਬਾਅਦ ਠੀਕ ਹੈ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਜ਼ਰੂਰ ਅਤੇ ਉਹ ਦੇ ਵਿੱਚ ਟਾਈਮ ਕਿੰਨਾ ਕੁ ਲੱਗ ਜਾਂਦਾ ਹੈ ਕੁਰੈਕਸ਼ਨ ਹੋਣ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਹਾਂਜੀ ਹਾਂ ਮੈਂ ਸੋਮਵਾਰ ਦੇਖਾਂਗਾ ਸੋਮਵਾਰ ਚੱਲਾਂਗਾ ਅਤੇ ਮੈਨੂੰ ਦੱਸ ਦਿਓ ਫਿਰ ਇਕੱਠੇ ਚੱਲ ਪਵਾਂਗੇ ਕੋਈ ਗੱਲ ਨਹੀਂ ਪਰ ਇਹ ਮੈਨੂੰ ਦੱਸੋ ਜੇ ਤਤਕਾਲ 'ਚ ਹਾਂਜੀ ਜੇ ਤਤਕਾਲ 'ਚ ਕਢਵਾਉਣਾ ਹੋਵੇ ਫੇਰ ਕਿਵੇਂ ਨਿਕਲੇਗਾ ਮੈਨੂੰ ਅਰਜੈਂਟ ਚਾਹੀਦਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਫਿਰ ਮੈਂ ਆਜੂਗਾ ਆਪਾਂ ਇਕੱਠੇ ਚੱਲ ਪਵਾਂਗੇ ਫਿਰ ਠੀਕ ਹੈ ਜੀ ਓ ਓਕੇ